ਹੈਲੋ ਹਾਂ ਹਾਂਜੀ ਤੁਸੀਂ ਨਾ ਉਹ ਨੇਚਰ ਨਰਸਰੀ ਤੋਂ ਬੋਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਨੂੰ ਆਪਾਂ ਨੂੰ ਨਾ ਪਲਾਂਟ ਚਾਹੀਦੇ ਹੈਗੇ ਆ ਜਿਹੜੇ ਆਪਾਂ ਅੰਦਰ ਰੱਖ ਸਕੀਏ ਅਤੇ ਬਾਹਰ ਰੱਖਣ ਵਾਲੇ ਕੁਛ ਹੋਣ ਅਤੇ ਅਤੇ ਬਾਕੀ ਆਪਾਂ ਉਹਨੂੰ ਤੁਹਾਨੂੰ ਫਿਰ ਸਾਰੀ ਨੌਲੇਜ ਦੱਸ ਦਿਓ ਤੁਹਾਡੇ ਕੋਲ ਕਿਹੜੇ ਕਿਹੜੇ ਪਲਾਂਟ ਹੈਗੇ ਆ ਅਤੇ ਕਿੰਨੇ ਕਿੰਨੇ ਦੇ ਆ ਅਤੇ ਉਹਨਾਂ ਦੀ ਸਾਂਭ ਸੰਭਾਲ ਅਤੇ ਆਪਾਂ ਨਵੀਂ ਕੋਠੀ ਬਣਾਈ ਅਤੇ ਆਪਾਂ ਉਹਦੇ 'ਚ ਰੱਖਣੇ ਆ ਅੰਦਰ ਵੀ ਅਤੇ ਬਾਹਰ ਵੀ ਸਾਰੇ ਕਿਤੇ ਅਤੇ ਬਾਕੀ ਕੋਈ ਡਿਸਕਾਊਂਟ ਜੋ ਸਾਨੂੰ ਦਿਓਗੇ ਸਾਨੂੰ ਉਹ ਵੀ ਦੱਸ ਦਿਆ ਜੀ ਹਾਂਜੀ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਆਪਣੀ ਕੋਠੀ ਬਹੁਤ ਖੁੱਲ੍ਹੀ ਹਵਾਦਾਰ ਹੈ ਅਤੇ ਜਿਹੜੀ ਉਹ ਖੁੱਲ੍ਹੀ ਹਵਾਦਾਰ ਕੋਠੀ ਵਿੱਚ ਜਿਹੜੇ ਅੰਦਰ ਰੱਖਣ ਵਾਲੇ ਆ ਅਤੇ ਉਹ ਵੀ ਆਪਾਂ ਪੇ ਕਰਾਂਗੇ ਅਤੇ ਜਿਹੜੇ ਬਾਹਰ ਰੱਖਣ ਵਾਲੇ ਆ ਅਤੇ ਉਹ ਵੀ ਆਪਾਂ ਪੇ ਕਰਾਂਗੇ

ਠੀਕ ਹੈ ਠੀਕ ਹੈ ਓਕੇ

ਹਮ ਹਮ ਹਾਂ ਉਹ ਵੀ ਆਪਾਂ ਉਹ ਵੀ ਆਪਾਂ ਲੈ ਲਾਂਗੇ ਆਪਾਂ ਨੂੰ ਸਾਰੇ ਹੀ ਚਾਹੀਦੇ ਆ ਆਪਾਂ ਹਾਂਜੀ ਤਾਂ ਫਿਰ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਅਤੇ ਆਪਾਂ ਨੂੰ ਡਿਸਕਾਊਂਟ ਵੱਧ ਤੋਂ ਵੱਧ ਦਿਓ ਸਾਨੂੰ ਫਿਰ ਅਸੀਂ ਇੰਨੇ ਤੁਹਾਡੇ ਕੋਲੋਂ ਪੌਦੇ ਖਰੀਦਣੇ ਆ ਚਲੋ ਠੀਕ ਹੈ ਫਿਰ ਨਾ ਤੁਸੀਂ ਇੰਝ ਕਰਿਓ ਵੀ ਤੁਹਾਡੇ ਕੋਲ ਆਉਣ ਦਾ ਟਾਈਮ ਨਹੀਂ ਹੋਣਾ ਤੁਸੀਂ ਆਨਲਾਈਨ ਸਾਡੇ ਪੌਦੇ ਭੇਜ ਦਿਆ ਜੇ ਅਤੇ ਅਸੀਂ ਤੁਹਾਨੂੰ ਗੂਗਲ ਪੇ ਕਰ ਦਾਂਗੇ ਅਸੀਂ ਅਤੇ ਕਿੰਨੀ ਤੁਹਾਡੀ ਪੇਮੈਂਟ ਬਣੀ ਤੁਸੀਂ ਸਾਨੂੰ ਉਹ ਵੀ ਫੋਨ 'ਤੇ ਦੱਸ ਦਿਓ ਅਤੇ ਅਸੀਂ ਫਿਰ ਗੂਗਲ ਪੇ ਕਰ ਦਾਂਗੇ ਤੁਹਾਨੂੰ ਹਾਂ ਠੀਕ ਹੈ ਨਾ ਅਤੇ ਹਾਂਜੀ ਵੈਲਕਮ ਵੈਲਕਮ ਜੀ ਓਕੇ